ਚਿੱਤਰਕਾਰੀ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਕ ਸੀਗਾ ਅਤੇ ਅਖੀਰ ਫੇਰ ਮੇਰਾ ਵਧੀਆ ਸ਼ੌਕ ਪੂਰਾ ਹੋਇਆ ਪਲਸ ਵਨ ਪਲਸ ਟੂ 'ਚ ਮੈਂ ਵਿਕੇਸ਼ਨਲ ਪਲਸ ਵਨ ਪਲਸ ਟੂ 'ਚ ਕੀਤੀ ਉਹ 'ਚ ਸਬਜੈਕਟ ਸੀ ਮੇਰੇ ਕੋਲ ਇੰਜਨੀਅਰਿੰਗ ਡਰਾਇੰਗ ਉੱਥੇ ਮੈਨੂੰ ਟੀਚਰ ਨੇ ਉਹ ਸਰਕਾਰੀ ਟੀਚਰ ਸੀਗੇ ਦੋ ਟੀਚਰ ਸੀ ਸਾਡੇ ਬੱਚੇ ਅਸੀਂ ਜ਼ਿਆਦਾ ਨਹੀਂ ਸੀਗੇ ਵੀਹ ਪੱਚੀ ਬੱਚੇ ਸੀਗੇ ਕਲਾਸ 'ਚ ਅਤੇ ਬਹੁਤ ਵਧੀਆ ਸਿਖਾਇਆ ਉਹਨਾਂ ਨੇ ਜਿਵੇਂ ਆਪਾਂ ਕੋਈ ਵੀ ਇਮੇਜ ਬਣਾਉਂਦੇ ਹਾਂ ਉਹਨੂੰ ਰੀਅਲ 'ਚ ਉਹ ਕਿਵੇਂ ਦਿੱਖਦੀ ਆ ਨੈਚੁਰਲ ਕਿਵੇਂ ਦਿੱਖਦੀ ਆ ਉਵੇਂ ਵੀ ਉਹ ਕੀਤੀ ਵਰਟੀਕਲ ਕਿਵੇਂ ਦਿਸੂਗੀ ਓਪੋਜਿਟ ਕਿਵੇਂ ਦਿਖੇਗੀ ਇਸ ਤਰ੍ਹਾਂ ਦੀ ਉਹ ਕੀਤੀ ਅਤੇ ਮੇਰੀ ਡਰਾਇੰਗ ਹੋਰ ਵੀ ਬੱਜਦੇ ਬੱਚੇ ਜਿਹੜੇ ਨਾਲ ਦੇ ਸੀ ਉਹ ਕਹਿ ਦਿੰਦੇ ਸੀ ਵੀ ਹਾਂ ਵੀ ਤੇਰੀ ਡਰਾਇੰਗ ਬਹੁਤ ਵਧੀਆ ਹੈਗੀ ਤੂੰ ਸਾਡੀ ਬਣਾ ਦੇ ਮੈਂ ਚੋਰਿਉਂ ਛੁੱਪੇ ਫਿਰ ਉਹਨਾਂ ਦੀ ਬਣਾ ਦਿੰਦਾ ਨਹੀਂ ਤਾਂ ਟੀਚਰ ਲੜਦਾ ਸੀਗਾ ਉਹਨਾਂ ਦੀ ਬਣਾ ਕੇ ਮੈਂ ਦਿਖਾ ਦਿੰਦਾ ਹੋਰ ਵੀ ਮੈਨੂੰ ਪਿੰਡ 'ਚੋਂ ਵੀ ਕਾਫੀ ਬੰਦਿਆਂ ਨੇ ਕਿਹਾ ਵੀ ਸਾਡੀ ਜਿਹੜਾ ਇਸ ਤਰ੍ਹਾਂ ਦੀ ਡਰਾਇੰਗ ਬਣਾ ਕੇ ਦੇਈਂ ਤੂੰ ਜਾਂ ਪ੍ਰੈਕਟੀਕਲ ਬਣਾ ਕੇ ਦੇਈਂ ਕੋਈ ਉਹਦੇ 'ਚ ਚਿੱਤਰ ਹੁੰਦੇ ਸੀਗੇ ਉਹ ਬਣਾ ਕੇ ਮੈਂ ਕਾਫੀ ਦਿੱਤੇ ਵੀ ਅਤੇ ਕਾਫੀ ਪਸੰਦ ਕੀਤੇ ਹੋਰ ਮੈਂ ਯੂਟੀਊਬ ਤੋਂ ਵੀ ਕਾਫੀ ਇਹਦਾ ਲਿਆ ਉੱਥੇ ਵੀ ਮੈਨੂੰ ਇੱਕ ਟੀਚਰ ਵਧੀਆ ਮਿਲਿਆ ਉਹਨਾਂ ਨੇ ਵੀ ਕਾਫੀ ਦੱਸਿਆ ਜਿਵੇਂ ਸ਼ੇਡਿੰਗ ਵਗੈਰਾ ਦੱਸਿਆ ਕਿ ਇੱਕ ਸਾਈਡ ਤੋਂ ਹੀ ਕਰੋ ਜੇ ਕੋਈ ਕਿਤੇ ਕੋਈ ਉਹ ਕਰੋਸ ਆਉਂਦਾ ਉੱਥੇ ਸਾਈ ਸ਼ੇਡ ਬਦਲੋ ਊਂ ਨਾ ਬਦਲੋ ਊਂ ਬਸ ਇਕ ਸ਼ੇਡ 'ਤੇ ਹੀ ਕਰੋ ਤੁਸੀਂ